ਪੰਜਾਬ 'ਚ ਬਹੁਤ ਪਰੰਪਰਾਵਾਂ ਹਨ ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲ ਰਹੀਆਂ ਹਨ ਜਿਵੇਂ ਕਿ ਲੋਕ ਗੀਤ ਵਿਆਹਾਂ 'ਚ ਘੋੜੀਆਂ ਅਤੇ ਸੁਹਾਗ ਗਾਏ ਜਾਂਦੇ ਹਨ ਜਾਗੋ ਕੱਢੀ ਜਾਂਦੀ ਹੈ ਨਾਨਕਿਆਂ ਦੀ ਜਾਗੋ ਦਾਦਕਿਆਂ ਦੀ ਜਾਗੋ ਕੱਢੀ ਜਾਂਦੀ ਹੈ ਅਤੇ ਭੰਗੜਾ ਗਿੱਧਾ ਬਿਨਾਂ ਵਿਆਹ ਦਾ ਚਾਅ ਪੂਰਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਦੇ ਨਾਲ ਹੀ ਵਿਆਹ ਸ਼ਾਦੀਆਂ ਚੰਗੀਆਂ ਲੱਗਦੀਆਂ ਹਨ ਜਿਵੇਂ ਕਿ ਭੰਗੜੇ ਦੇ ਸੰਮੀ ਮਲਵਾਈ ਗਿੱਧਾ ਲੁੱਡੀ ਝੂੰਮਰ ਪਾਇਆ ਜਾਂਦਾ ਹੈ ਇਹ ਭੰਗੜੇ ਦੇ ਸਾਰੇ ਇਹ ਹਿੱਸੇ ਹਨ ਅਤੇ ਜਿਵੇਂ ਕਿ ਘੋੜੀਆਂ ਦੇ ਵਿੱਚ ਗਾਇਆ ਜਾਂਦਾ ਗੀਤਾਂ 'ਚ ਗਾਇਆ ਜਾਂਦਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਵੇ ਜਾਣਾ ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ਼ ਜਾਣਾ ਗੀਤ ਗਾਏ ਜਾਂਦੇ ਹਨ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ ਜਿਵੇਂ ਕਿ ਘੋੜੀਆਂ ਕੱਢੀਆਂ ਜਾਂਦੀਆਂ ਹਨ ਘੋੜੀ ਇੱਕ ਲੱਖ ਦੀ ਘੋੜੀ ਦੋ ਲੱਖ ਦੀ ਨੀ ਮੈਂ ਤਿੰਨ ਲੱਖ ਮੁੱਲ ਪਵਾਵਾਂ ਆ ਕਹਿੰਦੇ ਹਨ ਬੈਠ ਕਸੀਦਾ ਕੱਢ ਰਹੀ ਆ ਨੀ ਬੀਬੀ ਚੰਦਨ ਦੇ ਓਲੇ ਓਲੇ ਕਿਉਂ ਖੜ੍ਹੀ ਖੜ੍ਹੀ ਹਾਂ ਬਾਬਲ ਜੀ ਦੇ ਪਾਸ ਕਰਾਂ ਅਰਦਾਸ ਬਾਬਲ ਵਰ ਲੋੜੀਏ ਨੀ ਧੀਏ ਕਿਹੋ ਜਿਹਾ ਵਰ ਲੋੜੀਏ ਸੋ ਇਸ ਤਰ੍ਹਾਂ ਦੇ ਗੀਤ ਗਾਏ ਜਾਂਦੇ ਹਨ ਵਿਆਹ ਸ਼ਾਦੀ ਬਹੁਤ ਸੋਹਣੇ ਲੱਗਦੇ ਹਨ ਸੋ ਸਾਡਾ ਜਿਹੜਾ ਇਹ ਇਹ ਪਰੰਪਰਾਵਾਂ ਨੇ ਪੀੜ੍ਹੀ ਦਰ ਪੀੜ੍ਹੀ ਚੱਲੀਆਂ ਆਉਂਦੀਆਂ ਹਨ ਵਿਆਹ ਸ਼ਾਦੀਆਂ ਦੇ ਵਿੱਚ ਰੌਣਕਾਂ ਲਾਈਆਂ ਜਾਂਦੀਆਂ ਹਨ ਪਰ ਇਹਨਾਂ ਤੋਂ ਬਿਨਾਂ ਵੀ ਵਿਆਹ ਸ਼ਾਦੀ ਜਿਹੜਾ ਏ ਅਧੂਰਾ ਲੱਗਦਾ ਹੈ ਜਿੰਨਾ ਚਿਰ ਗੀਤ ਨਾ ਗਾਏ ਜਾਣ ਢੋਲਕੀਆਂ ਨਾ ਵੱਜਣ ਛੈਣੇ ਨਾ ਵੱਜਣ ਕਿਧੜਾ ਗਿੱਧਾ ਭੰਦ ਭੰਗੜਾ ਨਾ ਪਵੇ ਤਾਂ ਵਿਆਹ ਸੋਹਣੇ ਨਹੀਂ ਲੱਗਦੇ ਇਹ ਰੌਣਕਾਂ ਪੰਜਾਬ ਦੇ ਵਿੱਚ ਬਹੁਤ ਸੋਹਣੀਆਂ ਲੱਗਦੀਆਂ ਹਨ ਜਿਵੇਂ ਮਤਲਬ ਕਿ ਕੁੜੀ ਵਿਆਹੀ ਜਾਂਦੀ ਹੈ ਲੜਕੇ ਦਾ ਵਿਆਹ ਹੁੰਦਾ ਹੈ ਬਹੁਤ ਕੁਝ ਕਰਦੇ ਹਨ ਬੜੇ ਰਿਸ਼ਤੇਦਾਰ ਭੈਣ ਭਰਾ ਇਕੱਠੇ ਹੋ ਕੇ ਸਾਰਿਆਂ ਦੇ ਇਕੱਠੇ ਹੋਣ ਨਾਲ ਹੀ ਰੌਣਕ ਬਣਦੀ ਹੈ ਅਤੇ ਸੋਹਣੇ ਲੱਗੀ ਦਾ